ਮੈਂ ਇੱਕ ਵਾਰ ਔਨਲਾਈਨ ਗੇਮਿੰਗ ਟੂਰਨਾਮੈਂਟ ਵਿੱਚ ਫੁੱਟਬਾਲ ਦਾ ਜੋ ਵਰਲਡ ਕੱਪ ਹੈ ਉਸਦੇ ਵਿੱਚ ਹਿੱਸਾ ਲਿਆ ਸੀ ਉਸ ਵਿੱਚ ਮੈਂ ਆਪਣੀ ਟੀਮ ਭਾਰਤ ਚੁਣੀ ਸੀ ਅਤੇ ਉਸ ਵਿੱਚ ਅਸੀਂ ਜਿੱਤੇ ਵੀ ਸੀ ਅਤੇ ਇਸ ਕਰਕੇ ਮੈਨੂੰ ਤਾਂ ਉਹ ਬਹੁਤ ਹੀ ਵਧੀਆ ਲੱਗਿਆ